ਭੰਗੜਾ ਸਾਰਿਆਂ ਵਾਸਤੇ ਬਹੁਤ ਵਧੀਆ ਚੀਜ਼ ਹੈ ਇੱਕ ਕਿਉਂਕਿ ਇਹ ਸਿਹਤ ਵਾਸਤੇ ਵੀ ਬਹੁਤ ਵਧੀਆ ਆਪਾਂ ਭੰਗੜਾ ਪਾਉਂਦੇ ਹਾਂ ਉਹਦੇ ਨਾਲ ਸਰੀਰ ਜਿਹੜਾ ਤੰਦਰੁਸਤ ਹੋ ਜਾਂਦਾ ਸਰੀਰ ਭੰਗੜੇ ਦੇ ਨਾਲ ਸਾਰੇ ਪੁਰਾਣੇ ਜਿਹੜੇ ਗੀਤ ਨੇ ਲੋਕ ਗੀਤ ਨੇ ਉਹ ਸਾਰੇ ਆਪਣੇ ਬਹੁਤ ਅੱਛੇ ਲੱਗਦੇ ਨੇ ਸਾਰੇ ਰਲ ਕੇ ਆਪਾਂ ਮਤਲਬ ਸਾਰਿਆਂ ਨੂੰ ਸੰਗੀਤ ਕਰਦੇ ਆ ਕਰਦਿਆਂ ਵਜਾਮ ਵੀ ਹੋ ਜਾਂਦਾ ਸਰੀਰ ਦੇ ਨਾਲ ਵਿਜਾਮ ਵੀ ਹੋ ਜਾਂਦਾ ਇਸੇ ਤਰ੍ਹਾਂ ਹੀ ਸਾਰੇ ਇਕੱਠੇ ਰਲ ਕੇ ਆਪਣਾ ਸ ਸੰਗੀਤ ਸੰਗੀਤ ਵੀ ਕਰਦੇ ਆ ਭੰਗੜਾ ਵੀ ਕਰਦੇ ਆ ਭੰਗੜਾ ਬੱਚਿਆਂ ਵਾਸਤੇ ਬਹੁਤ ਅੱਛਾ ਭੰਗੜਾ ਹਰ ਇੱਕ ਵਾਸਤੇ ਬਹੁਤ ਅੱਛਾ ਕਿਉਂਕਿ ਇਹ ਇਹ ਭੰਗੜਾ ਜਿਹੜਾ ਨਾ ਇਹ ਐਕਸਰਸਾਈਜ਼ ਇਕ ਤਰ੍ਹਾਂ ਦੀ ਇੱਕ ਇੱਕ ਮਨੋਰੰਜਨ ਹੈ ਆਪਣੇ ਸਰੀਰ ਸਰੀਰ ਵਾਸਤੇ ਵੀ ਸਿਹਤ ਵਾਸਤੇ ਵੀ ਆਪਣੇ ਮਤਲਬ ਆਂਢ ਗੁਆਂਢ ਇੱਕ ਦੂਸਰੇ ਦੇ ਨਾਲ ਰਲ ਕੇ ਜੇ ਆਪਾਂ ਗੱਲਾਂ ਬਾਤਾਂ ਕਰਦੇ ਹਾਂ ਜਾਂ ਭੰਗੜਾ ਪਾਉਂਦੇ ਹਾਂ ਉਹਦੇ ਵਿੱਚ ਇਸ ਤਰ੍ਹਾਂ ਲੱਗਦਾ ਵਾ ਜਿਵੇਂ ਆਪਾਂ ਬਹੁਤ ਕੁਛ ਲੈ ਲਿਆ ਬਹੁਤ ਕੁਛ ਸਿੱਖ ਲਿਆ ਬਹੁਤ ਕੁਛ ਆਪਣੇ ਨਾਲ ਮਤਲਬ ਈਸ਼ਵਰ ਦੀ ਦਇਆ ਦੇ ਨਾਲ ਬਹੁਤ ਮਜ਼ਾ ਆ ਗਿਆ ਬਹੁਤ ਅਨੰਦ ਆ ਗਿਆ ਅਤੇ ਬਹੁਤ ਭੰਗੜਾ ਬਹੁਤ ਬਹੁਤ ਵਧੀਆ ਚੀਜ਼ ਆ ਸਾਰੇ ਇਸ ਨੂੰ ਸਾਰੇ ਇਸ ਨੂੰ ਮੰਨ ਕੇ ਚੱਲੋ ਵੀ ਭੰਗੜਾ ਬਹੁਤ ਵਧੀਆ ਚੀਜ਼ ਹੈ ਧੰਨਵਾਦ ਜੀ